ਹੈਲੋ ਹਾਂਜੀ ਤੁਸੀਂ ਕੌਣ ਅੱਛਾ ਅੱਛਾ ਕੀ ਨਾਮ ਹੈ ਤੁਹਾਡਾ ਅੱਛਾ ਹਾਂ ਕੁਲਵਿੰਦਰ ਬੋਲ ਹਾਂ ਉਹ ਮੇਰੇ ਧਿਆਨ 'ਚ ਨਹੀਂ ਰਿਹਾ ਹਾਂ ਹਾਂ ਹਾਂ ਦੱਸ ਅੱਛਾ ਨਹੀਂ ਤੁਸੀਂ ਇਹ ਨਾ ਪਤਾ ਕੀ ਗੱਲ ਆ ਜਿਹੜੇ ਮਤਲਬ ਏਰੀਏ 'ਚ ਤੁਸੀਂ ਰਹਿੰਦੇ ਹੋਵੋਗੇ ਉ ਪ੍ਰੋਬਲਮ ਹੋ ਸਕਦੀ ਆ ਊਂ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ ਇੱਥੇ ਦੋ ਹਾਂ ਨਹੀਂ ਐਂ ਤਾਂ ਰਹਿੰਦੀ ਹੈ ਦੋ ਕੁ ਮਹੀਨੇ ਤਾਂ ਰਹੇਗੀ ਦੋ ਕੁ ਮਹੀਨੇ ਰਹੇਗੀ ਵੀ ਮਤਲਬ ਥੋੜ੍ਹਾ ਜਿਹਾ ਨਾ ਖੇਤੀ ਪਿੰਡਾਂ ਦੇ ਨੇੜੇ ਹੋਣ ਕਰਕੇ ਕੋਲਜ ਹੈ ਨਾ ਖੇਤੀ ਕਰਦੇ ਹੈਗੇ ਲੋਕ ਪਿੰਡਾਂ ਦੇ ਆ ਪਰਾਲੀ ਨੂੰ ਅੱਗ ਲਾਉਂਦੇ ਉਹਦੇ ਨਾਲ ਪ੍ਰਦੂਸ਼ਣ ਥੋੜ੍ਹਾ ਜਿਹਾ ਜ਼ਿਆਦਾ ਹੋ ਜਾਂਦਾ ਪਰ ਇਹ ਦੋ ਕੁ ਮਹੀਨਿਆਂ ਦੀ ਗੱਲ ਹੈ ਹਾਂ ਉਸ ਤੋਂ ਬਾਅਦ ਠੀਕ ਹੋ ਜੂਗਾ ਮੌਸਮ ਅੱਛਾ ਬਾਕੀ ਜੇ ਤੂੰ ਚਾਹੇ ਆਪਾਂ ਪੀ ਜੀ ਚੇਂਜ ਕਰ ਸਕਦੇ ਹਾਂ ਤੇਰਾ ਸਾਡੇ ਵਾਲੇ ਏਰੀਏ 'ਚ ਹਾਂ ਹਾਂ ਨਹੀਂ ਹੈਗੀ ਆ ਕੋਈ ਗੱਲ ਨਹੀਂ ਜੇ ਤੂੰ ਕਰਨੀ ਹੋਈ ਗੱਲ ਮੈਂ ਗੱਲ ਕਰਵਾ ਦੂੰਗੀ ਤੇਰੀ ਉਹਨਾਂ ਦੇ ਓਨਰ ਨਾਲ ਨਹੀਂ ਨਹੀਂ ਕੋਈ ਹਾਂ ਹਾਂ ਕਰਵਾ ਦੂੰਗੀ ਮੈਂ ਤੂੰ ਚੇਂਜ ਕਰ ਦੇਈਂ ਪੀ ਜੀ ਫਿਰ ਕੋਈ ਪ੍ਰੋਬਲਮ ਨਹੀਂ ਆਊਗੀ ਅਤੇ ਥੋੜ੍ਹਾ ਜਿਹਾ ਵਧੀਆ ਹੈਗਾ ਏਰੀਆ ਨਹੀਂ ਹੁੰਦਾ ਸਾਰੇ ਬੱਚਿਆਂ ਨੂੰ ਆ ਨਵਿਆਂ ਨੂੰ ਨਾ ਹੋ ਜਾਂਦੀ ਹੈ ਪ੍ਰੋਬਲਮ ਇਹ ਕੋਈ ਗੱਲ ਨਹੀਂ ਆਪਾਂ ਪੀ ਜੀ ਚੇਂਜ ਕਰਵਾ ਦਵਾਂਗੇ ਤੇਰਾ ਤੂੰ ਆ ਜਾਈਂ ਆਪਾਂ ਗੱਲ ਕਰ ਦਵਾਂਗੇ ਓਕੇ ਓਕੇ ਓਕੇ ਓਕੇ ਓਕੇ